ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਫੁੱਟਬਾਲ ਦੀ ਜੀ ਅਤੇ ਕਬੱਡੀ ਜੀ ਤੁਸੀਂ ਕਿਹੜੀ ਦੀ ਲੈਣਾ ਚਾਹੁੰਦੇ ਹੋ ਜੀ ਹਾਂਜੀ ਫੀਸ ਜੀ ਬਾਰ੍ਹਾਂ ਤੇਰ੍ਹਾਂ ਹਜ਼ਾਰ ਰੁਪਇਆ ਹੈ ਜੀ ਮਹੀਨੇ ਦਾ ਬਾਕੀ ਕੋਈ ਨਾ ਜੀ ਜਦੋਂ ਤੁਸੀਂ ਆਓਗੇ ਸਾਡੇ ਕੋਚਿੰਗ ਸੈਂਟਰ 'ਤੇ ਉਦੋਂ ਆਪਾਂ ਗੱਲ ਕਰ ਲਵਾਂਗੇ ਥੋੜ੍ਹੀ ਬਹੁਤੀ ਦੇਖ ਲਵਾਂਗੇ ਚਲ ਤੁਸੀਂ ਐਂਏ ਕਰਿਓ ਜੀ ਸਾਢੇ ਗਿਆਰ੍ਹਾਂ ਦੇ ਦਿਓ ਜੀ ਨਾਲ ਇੱਕ ਸਟੂਡੈਂਟ ਹੋਰ ਵੇਖ ਲਿਓ ਮਿਲਦਾ ਹੋਇਆ ਤਾਂ ਹਾਂਜੀ ਫਿਰ ਪੰਜ ਸੌ ਇੱਕ ਸਟੂਡੈਂਟ ਵਾਂਗ ਹੋਰ ਹੈ ਜੀ ਜਿਵੇਂ ਤੁਸੀਂ ਇੱਕ ਸਟੂਡੈਂਟ ਲਿਆਓਗੇ ਪੰਜ ਸੌ ਜੇ ਦੋ ਲਿਆਓਗੇ ਤਾਂ ਹਜ਼ਾਰ

ਅੱਛਾ ਹਾਂ ਹਾਂ ਫਿਰ ਉਵੇਂ ਉਵੇਂ ਤੁਹਾਨੂੰ ਫੀਸ ਲੈਸ ਹੋ ਜਾਵੇਗੀ ਹਾਂਜੀ ਟਾਈਮ ਸਵੇਰੇ ਵੇਖ ਲਓ ਜੀ ਆ ਸਕਦੇ ਹੋ ਤਾਂ ਤੁਸੀਂ ਛੇ ਤੋਂ ਫਿਰ ਚਾਰ ਵਜੇ ਦੇਖ ਲਿਓ ਜੀ ਸ਼ਾਮ ਨੂੰ ਹਾਂਜੀ ਛੇ ਸਾਢੇ ਛੇ ਵੱਜ ਜਾਂਦੇ ਕਈ ਵਾਰੀ

ਥੈਂਕ ਯੂ ਜੀ